ਗਾਇਨ ਗੁਰੂ ਤੋਂ ਹੀ ਵਧੀਆ ਸਿੱਖੀ ਜਾਂਦੀ ਹੈ ਮੇਰੇ ਵੀ ਇੱਕ ਗਾਇਨ ਅਧਿਆਪਕ ਹਨ ਜਿਨ੍ਹਾਂ ਦਾ ਨਾਮ ਹੈ ਚਰਨਜੀਤ ਸਿੰਘ ਉਹਨਾਂ ਦਾ ਸੰਗੀਤ ਲਈ ਜਨੂੰਨ ਬਹੁਤ ਹੀ ਉੱਚਾ ਹੈ ਮੇਰੇ ਅਧਿਆਪਕ ਸੰਗੀਤ ਲਈ ਡੂੰਘੇ ਪਿਆਰ ਦੇ ਨਾਲ ਨਾਲ ਹਰ ਪਾਠ ਵਿੱਚ ਸ਼ਿਲਪਕਾਰੀ ਅਤੇ ਉਤਸ਼ਾਹ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ ਉਹਨਾਂ ਦਾ ਅਟੁੱਟ ਸਮਰਪਣ ਉਸ ਤਰੀਕੇ ਨਾਲ ਜ਼ਾਹਰ ਹੁੰਦਾ ਹੈ ਜਿਸ ਤਰੀਕੇ ਨਾਲ ਉਹ ਆਪਣੇ ਅਪ ਅਧਿਆਪਨ ਤੱਕ ਪਹੁੰਚਦੇ ਹਨ ਹਰ ਸੈਸ਼ਨ ਨੂੰ ਇੱਕ ਸੰਗੀਤਕ ਖੋਜ ਬਣਾਉਂਦੇ ਹਨ ਉਹ ਮੇਰੇ ਸੁਰਾਂ ਵਿੱਚ ਬਹੁਤ ਹੀ ਮਦਦ ਕਰਦੇ ਹਨ